ਮੈਂ ਸਮੁੰਦਰ ਪਹਾੜ ਇਤਿਹਾਸਿਕ ਸਥਾਨ 'ਤੇ ਵੀ ਜਾਣਾ ਪਸੰਦ ਕਰਦੀ ਹਾਂ ਮੈਂ ਮੰਦਿਰ ਜਿਵੇਂ ਕਿ ਵਰਿੰਦਾਵਨ ਜਾ ਕੇ ਬਹੁਤ ਜ਼ਿਆਦਾ ਪਸੰਦ ਕਰਦੀ ਹਾਂ ਕਿਉਂਕਿ ਵਰਿੰਦਾਵਨ ਵਿੱਚ ਕ੍ਰਿਸ਼ਨ ਅਤੇ ਰਾਧਾ ਰਾਣੀ ਸਾਕਸ਼ਾਤ ਹਨ ਉਹਨਾਂ ਦੇ ਉੱਥੇ ਵਰਕਸ਼ ਵਰਕਸ਼ ਡਾਲੀ ਡਾਲੀ ਰਾਧੇ ਰਾਧੇ ਕਰਦੀ ਹੈ ਅਤੇ ਉਹ ਸਾਕਸ਼ਾਤ ਲੀਲਾ ਕਰਦੇ ਹਨ ਜਿਹੜੇ ਕਿ ਸਾਨੂੰ ਇਸ ਅੱਖਾਂ ਦੇ ਨਾਲ ਇਸ ਭੌਤਿਕ ਦੁਨੀਆ ਦੇ ਨਾਲ ਨਜ਼ਰ ਨਹੀਂ ਆਉਂਦੇ ਲੇਕਿਨ ਉੱਥੋਂ ਦੇ ਜਿਹੜੇ ਰਿਸ਼ੀ ਮੁਨੀ ਹੈ ਜਾਂ ਪਹਾੜ ਹੈ ਜਾਂ ਪੌਦੇ ਹੈ ਜਾਂ ਪੇੜ ਹੈ ਉਹ ਉਹਨਾਂ ਨੂੰ ਹਰ ਤਰ੍ਹਾਂ ਦੇ ਨਾਲ ਮਹਿਸੂਸ ਕਰਦੇ ਹਨ ਉਹਨਾਂ ਦੀ ਲੀਲਾਵਾਂ ਦਾ ਅਨੁਭਵ ਕਰਦੇ ਹਨ ਕ੍ਰਿਸ਼ਨ ਭਗਵਾਨ ਉੱਥੇ ਸਾਕਸ਼ਾਤ ਹਨ ਰਾਧਾ ਰਾਣੀ ਉੱਥੇ ਸਾਕਸ਼ਾਤ ਹੈ ਕਹਿੰਦੇ ਹਨ ਕਿ ਰਾਧਾ ਰਾਣੀ ਉਹਨਾਂ ਵਾਸਤੇ ਹਰ ਰੋਜ਼ ਨਵੇਂ ਨਵੇਂ ਪਕਵਾਨ ਬਣਾਉਂਦੀ ਹੈ ਅਤੇ ਨਿਧੀਵਨ ਦੇ ਵਿੱਚ ਉਹਨਾਂ ਦੀਆਂ ਬਹੁਤ ਸਾਰੀਆਂ ਲੀਲਾਵਾਂ ਹੁੰਦੀਆਂ ਹਨ ਜਿੱਥੇ ਕਿ ਉਹ ਰਾਤ ਨੂੰ ਆਪਣਾ ਆਉਂਦੇ ਹਨ ਅਤੇ ਉੱਥੇ ਰਾਸਲੀਲਾ ਕਰਦੇ ਹਨ ਜਿਹੜੇ ਕਿ ਸਵੇ ਉਹ ਉਹਨਾਂ ਨੂੰ ਕਿਸੇ ਨੂੰ ਵੀ ਨਜ਼ਰ ਨਹੀਂ ਆਉਂਦੇ ਅਤੇ ਸਵੇਰੇ ਉੱਠ ਕੇ ਜਦੋਂ ਰਾਤ ਉਹ ਲਾ ਰਾਸ ਲੀਲਾ ਕਰ ਜਾਂਦੇ ਹਨ ਅਤੇ ਸਵੇਰੇ ਉੱਥੇ ਉਹਨਾਂ ਦੀ ਦਾਤਣ ਕੀਤੀ ਪਾਈ ਜਾਂਦੀ ਹੈ ਅਤੇ ਉਹਨਾਂ ਦਾ ਉਹ ਕ੍ਰਿਸ਼ਨ ਭਗਵਾਨ ਉੱਥੇ ਰਾਧਾ ਰਾਣੀ ਦਾ ਸ਼ਿੰਗਾਰ ਵੀ ਕਰਦੇ ਹਨ ਅਤੇ ਬੈੱਡ ਵੀ ਉਹਨਾਂ ਦਾ ਖਿਲਰਿਆ ਹੁੰਦਾ ਦਾਤਣ ਕੀਤੀ ਹੁੰਦੀ ਹੈ ਪਾਣੀ ਰੁੜਿਆ ਹੁੰਦਾ ਹੈ ਅਤੇ ਇੱਥੋਂ ਇਲਾਵਾ ਅਸੀਂ ਹੋਰ ਬਹੁਤ ਬਹੁਤ ਉੱਥੇ ਆਪਾਂ ਲੀਲਾਵਾਂ ਦਾ ਅਨੁਭਵ ਕਰਦੇ ਹਾਂ ਅਤੇ ਮੈਨੂੰ ਵਰਿੰਦਾਵਨ ਜਾਣਾ ਬਹੁਤ ਹੀ ਜ਼ਿਆਦਾ ਪਸੰਦ ਹੈ ਮੈਂ ਕ੍ਰਿਸ਼ਨ ਭਗਵਾਨ ਮੇਰੇ ਅਰਾਧੇ ਹਗੇ ਨੇ ਰਾਮ ਮੇਰੇ ਅਰਾਧੇ ਨੇ ਰਾਧਾ ਰਾਣੀ ਮੇਰੀ ਅਰਾਧੇ ਹੈ ਮੈਂ ਉਹਨਾਂ ਦੀ ਬਹੁਤ ਹੀ ਜ਼ਿਆਦਾ ਭਗਤ ਹਾਂ